ਸਿਹਤ ਦੇਖ ਰੇਖ ਤੱਕ ਪਹੁੰਚ ਕਰਨਾ ਚੁਣੌਤੀਆਂ ਨਾਲ ਭਰਪੂਰ ਹੋ ਸਕਦਾ ਹੈ ਖਾਸ ਕਰਕੇ ਘੱਟ ਸੇਵਾ ਵਾਲੇ ਅਤੇ ਪੇਂਡੂ ਖੇਤਰਾਂ ਵਿੱਚ ਜਿੱਥੇ ਬੁਨਿਆਦੀ ਢਾਂਚਾ ਅਤੇ ਸਰੋਤ ਸੀਮਿਤ ਹਨ ਪਿੰਡਾਂ ਵਿੱਚ ਅਣਢੁਕਵੇਂ ਸੜਕੀ ਨੈਟਵਰਕ ਸਿਹਤ ਸਹੂਲਤਾਂ ਤੱਕ ਆਵਾਜਾਈ ਵਿੱਚ ਪੂਰੀ ਤਰ੍ਹਾਂ ਰੁਕਾਵਟ ਪੈਦਾ ਕਰ ਸਕਦੇ ਹਨ ਜਿਸ ਨਾਲ ਵਸਨੀਕਾਂ ਲਈ ਜ਼ਰੂਰੀ ਦੇਖਭਾਲ ਤੱਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ ਖਾਸ ਤੌਰ 'ਤੇ ਐਮਰਜੈਂਸੀ ਜਾਂ ਪ੍ਰਤੀਕੂਲ ਮੌਸਮੀ ਸਥਿਤੀਆਂ ਦੌਰਾਨ ਬੁਨਿਆਦੀ ਢਾਂਚੇ ਦੀ ਘਾਟ ਜਿਵੇਂ ਕਿ ਨਾਕਾਫੀ ਸਿਹਤ ਦੇਖ ਰੇਖ ਸਹੂਲਤਾਂ ਸਾਜੋ ਸਮਾਨ ਸਮੀਖਿਅਕ ਕਰਮਚਾਰੀਆਂ ਇਹਨਾਂ ਮੁਸ਼ਕਲਾਂ ਨੂੰ ਹੋਰ ਮਿਸ਼ਰਤ ਕਰਦੇ ਹਨ ਜਿਸ ਨਾਲ ਸੇਵਾ ਦੀ ਉਪਲਬਧਤਾ ਅਤੇ ਗੁਣਵੱਤਾ ਵਿੱਚ ਅੰਤਰ ਪੈਦਾ ਹੁੰਦੇ ਹਨ ਸ਼ਹਿਰੀ ਖੇਤਰਾਂ ਵਿੱਚ ਭੀੜ ਭੜੱਕੇ ਵਾਲੇ ਆਊਟਪੇਸ਼ੈਂਟ ਵਿਭਾਗ ਓ ਬੀ ਡੀ ਐਸ ਲੰਮੇ ਇੰਤਜ਼ਾਰ ਦੇ ਸਮੇਂ ਅਤੇ ਦੇਖਭਾਲ ਡਿਲੀਵਰੀ ਦੀ ਕੁਸ਼ਲਤਾ ਨੂੰ ਘਟਾ ਕੇ ਸਮੱਸਿਆ ਨੂੰ ਹੋਰ ਵਧਾਉਣ ਦੇਣਾ ਇਹਨਾਂ ਮੁੱਦਿਆਂ ਦੇ ਨਤੀਜੇ ਵਜੋਂ ਦੇਰੀ ਨਾਲ ਮੈਦਾਨ ਨਾਕਾਫੀ ਅਤੇ ਸਮੁੱਚੇ ਇਲਾਜ ਨਾਕਾਫੀ ਇਲਾਜ ਸਮੁੱਚੇ ਤੌਰ 'ਤੇ ਮਾੜੇ ਸਿਹਤ ਨਤੀਜੇ ਹੋ ਸਕਦੇ ਹਨ ਇਹਨਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਇੱਕ ਬਹੁਪੱਖੀ ਪਹੁੰਚ ਦੀ ਲੋੜ ਹੈ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ ਜਿਵੇਂ ਕਿ ਬਿਹਤਰ ਸੜਕਾਂ ਦਾ ਨਿਰਮਾਣ ਭਰੋਸੇਯੋਗ ਜਨਤਕ ਆਵਾਜਾਈ ਵਿਕਲਪ ਪ੍ਰਦਾਨ ਕਰਨਾ ਸਿਹਤ ਸੰਭਾਲ ਸਹੂਲਤਾਂ ਤੱਕ ਪਹੁੰਚ ਵਿੱਚ ਮਹੱਤਵਪੂਰਨ ਵਾਧਾ ਕਰ ਸਕਦਾ ਹੈ ਨਵੇਂ ਸਿਹਤ ਕੇਂਦਰਾਂ ਦੇ ਨਿਰਮਾਣ ਦੁਆਰਾ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨਾ ਉਹਨਾਂ ਨੂੰ ਜ਼ਰੂਰੀ ਮੈਡੀਕਲ ਉਪਕਰਨਾਂ ਨਾਲ ਲੈਸ ਕਰਨਾ ਅਤੇ ਸਿਖਲਾਈ ਪ੍ਰਾਪਤ ਸਿਹਤ ਪੇਸ਼ੇਵਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਸੇਵਾ ਦੇ ਅੰਤਰ ਨੂੰ ਦੂਰ ਕਰਨ ਲਈ ਮਹੱਤਵਪੂਰਨ ਕਦਮ ਹਨ ਟੈਲੀਮੈਡੀਸਨ ਸੇਵਾਵਾਂ ਨੂੰ ਲਾਗੂ ਕਰਨਾ ਮਰੀਜ਼ਾਂ ਨੂੰ ਵਿਆਪਕ ਯਾਤਰਾ ਦੀ ਲੋੜ ਤੋਂ ਬਿਨਾ ਸਿਹਤ ਪੇਸ਼ੇਵਰਾਂ ਨਾਲ ਸਲਾਹ ਕਰਨ ਦੀ ਆਗਿਆ ਦੇ ਕੇ ਦੂਰ ਦੁਰਾਡੇ ਖੇਤਰਾਂ ਵਿੱਚ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦਾ ਹੈ ਸ਼ਹਿਰੀ ਸੈਟਿੰਗਾਂ ਵਿੱਚ ਵਾਧੂ ਸਟਾਫਿੰਗ ਬਿਹਤਰ ਸਰੋਤ ਪ੍ਰਬੰਧਨ ਅਤੇ ਸੁਚਾਰੂ ਪ੍ਰਕਿਰਿਆਵਾਂ ਰਾਹੀਂ ਓ ਪੀ ਡੀ ਦੀ ਸਮਰੱਥਾ ਨੂੰ ਵਧਾਉਣਾ ਭੀੜ ਭੜੱਕੇ ਨੂੰ ਘੱਟ ਕਰ ਸਕਦਾ ਹੈ ਅਤੇ ਉਡੀਕ ਸਮੇਂ ਨੂੰ ਘਟਾ ਸਕਦਾ ਹੈ ਇਸ ਤੋਂ ਇਲਾਵਾ ਕਮਿਊਨਿਟੀ ਅਧਾਰਤ ਸਿਹਤ ਪ੍ਰੋਗਰਾਮਾਂ ਅਤੇ ਮੋਬਾਇਲ ਕਲੀਨਿਕਾਂ ਨੂੰ ਉਤਸ਼ਾਹ ਕਰਨ ਘੱਟ ਸੇਵਾ ਵਾਲੇ ਖੇਤਰ ਤੱਕ ਦੇਖਭਾਲ ਵਧਾ ਸਕਦਾ ਹੈ ਸਮੁੱਚੀ ਪਹੁੰਚਯੋਗਤਾ ਵਿੱਚ ਸੁਧਾਰ ਕਰ ਸਕਦਾ ਹੈ ਇਹਨਾਂ ਚੁਣੌਤੀਆਂ ਨੂੰ ਨਿਯਤ ਹੱਲਾਂ ਨਾਲ ਸੰਬੋਧਿਤ ਕਰਕੇ ਅਸੀਂ ਸਿਹਤ ਦੇਖ ਰੇਖ ਦੀ ਪਹੁੰਚ ਨੂੰ ਵਧਾ ਸਕਦੇ ਹਾਂ ਸਮਾਨ ਸੇਵਾ ਪ੍ਰਦਾਨ ਕਰਨਾ ਯਕੀਨੀ ਬਣਾ ਸਕਦੇ ਹਾਂ ਅਤੇ ਵਿਭਿੰਨ ਆਬਾਦੀਆਂ ਵਿੱਚ ਸਿਹਤ ਨਤੀਜਿਆਂ ਵਿੱਚ ਸੁਧਾਰ ਕਰ ਸਕਦੇ ਹਾਂ